ਸਾਡੇ ਖਿਆਲ ਵਿੱਚ ਵੀ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਵੀ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਕੋਈ ਜਾਣਕਾਰੀ ਨਹੀਂ ਵੀ ਪਹਿਲੇ ਤਾਂ ਆਪਣੇ ਹੈਗੇ ਨੇ ਵੀ ਬੱਚੇ ਵੱਡੇ ਜਿਹਨਾਂ ਨੂੰ ਵੀ ਕੋਈ ਮਾੜਾ ਮੋਟਾ ਪਤਾ ਹੋਵੇਗਾ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਇਹਨਾਂ ਨੂੰ ਮੇਰੇ ਖਿਆਲ ਆਪਣੇ ਇਤਿਹਾਸ ਬਾਰੇ ਕੁਛ ਵੀ ਨਹੀਂ ਪਤਾ ਵੀ ਨਾ ਹੀ ਸਕੂਲਾਂ ਅਤੇ ਨਾ ਹੀ ਕਾਲਜਾਂ ਵਿੱਚ ਵੀ ਕੁਛ ਪੜ੍ਹਾਇਆ ਜਾ ਰਿਹਾ ਹੈ ਵੀ ਆਪਾਂ ਇਹ ਕਹਿ ਰਹੇ ਆ ਵੀ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਨਾ ਹੀ ਆਪਾਂ ਆਪਣੇ ਘਰ ਬੱਚਿਆਂ ਨੂੰ ਕੋਈ ਇਤਿਹਾਸ ਬਾਰੇ ਦੱਸਦੇ ਹਾਂ ਅਤੇ ਆਪਾਂ ਨੂੰ ਵੀ ਫਾਇਦਾ ਤਾਂ ਹੀ ਹੋਵੇਗਾ ਵੀ ਜੇ ਆਪਾਂ ਬੱਚਿਆਂ ਨੂੰ ਦੱਸੀਏ ਅਤੇ ਆਪਣੇ ਗੁਰੂ ਪੀਰਾਂ ਨਾਲ ਕੀ ਹੋਇਆ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਬਾਰੇ ਵੀ ਦੱਸੀਏ ਬੱਚਿਆਂ ਨੂੰ ਅਤੇ ਤਾਂ ਹੀ ਆਪਣੇ ਬੱਚੇ ਜਾਗਰੂਕ ਹੋਣਗੇ ਵੀ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਆਪਣੇ ਵੱਡ ਵਡੇਰਿਆਂ ਦਾ ਕੀ ਨਾਮ ਸੀਗਾ ਹੁਣ ਅੱਜ ਕੱਲ੍ਹ ਦੇ ਬੱਚਿਆਂ ਨੂੰ ਤਾਂ ਆਪਣੇ ਮਾਂ ਪਿਓ ਦੇ ਸਿਵਾ ਆਪਣੇ ਦਾਦਾ ਦਾਦੀ ਦਾ ਵੀ ਅੱਜ ਕੱਲ੍ਹ ਛੇਤੀ ਨਾਮ ਨਹੀਂ ਪਤਾ ਹੋਣਾ ਇਸੇ ਲਈ ਆਪਾਂ ਇਹ ਕਹਿੰਦੇ ਆ ਵੀ ਜੇ ਆਪਾਂ ਅੱਜ ਘਰ ਹੀ ਨਹੀਂ ਬੱਚਿਆਂ ਨੂੰ ਪੜ੍ਹਾਉਂਦੇ ਇਤਿਹਾਸ ਬਾਰੇ ਦੱਸਦੇ ਅਤੇ ਆਪਾਂ ਕਾਲਜਾਂ ਸਕੂਲਾਂ ਵਿੱਚ ਆਪਾਂ ਬੱਚਿਆਂ ਦੇ ਟੀਚਰਾਂ ਕੋਲੋਂ ਕੀ ਉਮੀਦਾਂ ਰੱਖ ਸਕਦੇ ਆ ਇਸੇ ਲਈ ਆਪਾਂ ਕਹਿ ਰਹੇ ਆ ਵੀ ਆਪਣੇ ਬੱਚਿਆਂ ਨੂੰ ਸਾਰਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸੀਏ ਜਾਗਰੂਕ ਤਾਂ ਕਰੀਏ ਧੰਨਵਾਦ